ਅਸੀਂ ਯਾਤਰਾ ਵਾਸਤੇ ਹਰਿਮੰਦਰ ਸਾਹਿਬ ਗਏ ਸੀ ਅਤੇ ਬਜਟ ਦੇ ਹਿਸਾਬ ਨਾਲ ਅਸੀਂ ਚਾਰ ਮਹੀਨੇ ਪਹਿਲਾਂ ਪੈਸੇ ਇਕੱਠੇ ਸ਼ੁਰੂ ਕਰਨੇ ਕਰ ਦਿੱਤੇ ਸੀ ਅਤੇ ਅਸੀਂ ਸਾਰਾ ਪਰਿਵਾਰ ਹਰਿਮੰਦਰ ਸਾਹਿਬ ਅੰਬਰਸਰ ਗਏ ਸੀ ਉਸ ਤੋਂ ਬਾਅਦ ਅਸੀਂ ਵਾਘਾ ਬੋਡਰ ਵੀ ਗਏ ਸੀ ਅਤੇ ਉਸ ਤੋਂ ਬਾਅਦ ਅਸੀਂ ਮਾਤਾ ਮਾਤਾ ਦੇ ਮੰਦਰ 'ਚ ਵੀ ਗਏ ਸੀ ਅਤੇ ਉਸ ਤੋਂ ਬਾਅਦ ਅਸੀਂ ਘੁੰਮ ਫਿਰ ਕੇ ਵਾਪਸ ਖਰੜ ਆ ਗਏ